ਖੇਡਾਂ ਲਈ ਸਰਕਾਰੀ ਖਰਚਾ ਵਧਾਉਣਾ ਅਤੇ ਹੋਰ ਫੰਡ ਜਾਰੀ ਕਰਨਾ ਉਹਨਾਂ ਦੇ ਵਿਕਾਸ ਅਤੇ ਕਈ ਤਰ੍ਹਾਂ ਦੇ ਲਾਹੇਵੰਦ ਨਤੀਜਿਆਂ ਦੀ ਪ੍ਰਾਪਤੀ ਲਈ ਮਹੱਤਵਪੂਰਨ ਹੈ ਖੇਡਾਂ ਜਨਤਕ ਸਿਹਤ ਸੱਭਿਆਚਾਰਕ ਸਮੂਲੀਅਤ ਅਤੇ ਰਾਸ਼ਟਰੀ ਮਾਨ ਵਿੱਚ ਇੱਕ ਜਰੂਰੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਵਧੀ ਹੋਈ ਫੰਡਿੰਗ ਇਹਨਾਂ ਖੇਤਰਾਂ ਵਿੱਚ ਮਹੱਤਵਪੂਰਨ ਸੁਧਾਰ ਲਿਆ ਸਕਦੀ ਹੈ ਇੱਥੇ ਦੱਸਿਆ ਗਿਆ ਹੈ ਕਿ ਨਿਵੇਸ਼ ਮਹਤਮਪੂਰਨ ਕਿਉਂ ਹੈ ਅਤੇ ਜੇਕਰ ਮੌਕਾ ਮਿਲਦਾ ਹੈ ਤਾਂ ਮੈਂ ਖੇਡਾਂ ਦੀ ਬਿਹਤਰੀ ਲਈ ਕਿਵੇਂ ਪਹੁੰਚ ਕਰਾਂਗਾ ਖੇਡਾਂ ਦੇ ਵਧੇ ਹੋਏ ਸਰਕਾਰੀ ਖਰਚੇ ਦੀ ਮਹੱਤਤਾ ਬੁਨਿਆਦੀ ਢਾਂਚਾ ਵਿਕਾਸ ਸਟੇਡੀਅਮ ਅਖਾੜੇ ਅਤੇ ਕਮਿਊਨਿਟੀ ਸਪੋਰਟਸ ਸੈਂਟਰਾਂ ਸਮੇਤ ਆਦੀ ਆਧੁਨਿਕ ਖੇਡ ਸਹੂਲਤਾਂ ਦੇ ਨਿਰਮਾਣ ਅਤੇ ਰੱਖ ਰਖਾ ਲਈ ਲੋੜੀਦੇ ਫੰਡਿੰਗ ਲਈ ਜਰੂਰੀ ਹੈ ਗਰਾਸ ਰੂਟ ਅਤੇ ਯੂਥ ਪ੍ਰੋਗਰਾਮ ਜਮੀਨੀ ਪੱਧਰ ਅਤੇ ਯੁਵਾ ਖੇਡ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨਾ ਨੌਜਵਾਨ ਪਰਵਿਤਾ ਨੂੰ ਪੈਦਾ ਕਰਨਾ ਸਰੀਰਕ ਗਤੀਵਿਧੀ ਨੂੰ ਉਤਸਾਹਿਤ ਕਰਨਾ ਅਤੇ ਭਵਿੱਖ ਵਿੱਚ ਖੇਡ ਉੱਤਮਤਾ ਲਈ ਇੱਕ ਨੀਹ ਬਣਾਉਣ ਵਿੱਚ ਮਦਦ ਕਰਦਾ ਹੈ ਅਥਲੀਟ ਵਿਕਾਸ ਸਿਖਲਾਈ ਪ੍ਰੋਗਰਾਮਾਂ ਕੋਚਿੰਗ ਅਤੇ ਅਥਲੀਟ ਵਿਕਾਸ ਕਰਨ ਲਈ ਵਿੱਤੀ ਸਹਾਇਤਾ ਅਥਲੀਟਾਂ ਨੂੰ ਉਹਨਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੈ ਆਰਥਿਕ ਪ੍ਰਭਾਵ ਖੇਡਾਂ ਦੀਆਂ ਘਟਨਾਵਾਂ ਅਤੇ ਸਹੂਲਤਾਂ ਸੈਰ ਸਪਾਟਾ ਨੌਕਰੀ ਦੀ ਸਿਰਜਣਾ ਅਤੇ ਸਥਾਨਕ ਕਾਰੋਬਾਰੀ ਮੌਕਿਆਂ ਰਾਹੀਂ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰਦੀ ਹੈ ਮੈਂ ਖੇਡਾਂ ਦੀ ਬਿਹਤਰੀ ਲਈ ਕੀ ਕਰਾਂਗਾ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਅਪਗਰੇਡ ਕਰੋ ਬਹੁਤ ਵਰਤੋਂ ਦੀ ਸਹੂਲਤ ਦਾ ਨਿਰਮਾਣ ਕਰਨਾ ਚਾਹੀਦਾ ਹੈ ਬਹੁਤ ਵਰਤੋ ਵਾਲੇ ਖੇਡ ਕੰਪਲੈਕਸਾਂ ਦੇ ਨਿਰਮਾਣ ਵਿੱਚ ਨਿਵੇਸ਼ ਕਰੋ ਜੋ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਗਦੀ ਵਿਧੀਆਂ ਨੂੰ ਪੂਰਾ ਕਰਦਾ ਹੈ ਮੌਜੂਦਾ ਸਥਾਨਾਂ ਦਾ ਆਧੁਨੀਕੀਕਰਨ ਕਰੋ ਮੌਜੂਦਾ ਖੇਡ ਸਥਾਨਾਂ ਦੀ ਕਾਰਜ ਕੁਸ਼ਲਤਾ ਸਿੱਖਿਆ ਸੁਰੱਖਿਆ ਅਤੇ ਦਰਸ਼ਕ ਅਨੁਭਵ ਨੂੰ ਵਧਾਉਣ ਲਈ ਉਹਨਾਂ ਦੇ ਨਵੀਨੀਕਰਨ ਅਤੇ ਤਕਨੀਕੀ ਅਪਗਰੇਡ ਲਈ ਫੰਡ ਅਲਾਟ ਕਰੋ ਅਥਲੀਟ ਸਹਾਇਤਾ ਨੂੰ ਵਧਾਓ ਸਕਾਲਰਸ਼ਿਪ ਅਤੇ ਵਿਤੀ ਸਹਾਇਤਾ ਪ੍ਰਭਾਵਸ਼ਾਲੀ ਅਥਲੀਟਾਂ ਦੀ ਸਿਖਲਾਈ ਅਤੇ ਸਿੱਖਿਆ ਵਿੱਚ ਸਹਾਇਤਾ ਕਰਨ ਲਈ ਸਕੋਲਰਸ਼ਿਪ ਪ੍ਰੋਗਰਾਮ ਦੇ ਵਿੱਤੀ ਸਹਾਇਤਾ ਵਿਕਲਪ ਬਣਾਓ ਲਿੰਗ ਸਮਾਨਤਾ ਔਰਤਾਂ ਦੀਆਂ ਖੇਡਾਂ ਅਤੇ ਮਹਿਲਾਂ ਅਥਲੀਟ ਲਈ ਬਰਾਬਰ ਫੰਡਿੰਗ ਅਤੇ ਸਹਾਇਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ